ਸਤਿ ਸ਼੍ਰੀ ਅਕਾਲ ਜੀ ਨਾਮ ਮੇਰਾ ਗੁਰਿੰਦਰ ਕੌਰ ਮੈਂ ਤੁਹਾਡੇ ਤੋਂ ਔਨਲਾਈਨ ਪੱਖਾ ਮੰਗਵਾਇਆ ਸੀ ਜੋ ਕਿ ਬਹੁਤ ਹੀ ਘਟੀਆ ਨਿੱਕਲਿਆ ਜਿਵੇਂ ਦਾ ਤੁਸੀਂ ਦੱਸਿਆ ਤਾਂ ਗਰੰਟੀ ਲਈ ਸੀ ਵੀ ਬਹੁਤ ਵਧੀਆ ਏ ਆਵਾਜ਼ ਨਹੀਂ ਹੋਵੇਗੀ ਕੁਝ ਨਹੀਂ ਹੋਵੇਗਾ ਉਹ ਤਾਂ ਉਲਟਾ ਹੈ ਇੱਕ ਤਾਂ ਇਹ ਆਵਾਜ਼ ਬਹੁਤ ਕਰਦਾ ਇੱਕ ਇਹਦੀ ਹਵਾ ਬਿਲਕੁਲ ਵੀ ਨਹੀਂ ਹੈਗੀ ਪਲੱਗ ਇਹਨੇ ਮੇਰੇ ਦੋ ਸਾੜ ਦਿੱਤੇ ਸਾਰੀ ਫਿਟਿੰਗ ਵੀ ਖਰਾਬ ਕਰਤੀ ਇਹ ਤੋਂ ਮੈਂ ਅਸੀਂ ਬਹੁਤ ਜ਼ਿਆਦਾ ਮੈਂ ਤੰਗ ਐਂਗੀ ਸਾਡੇ ਘਰਦੇ ਵੀ ਮੈਨੂੰ ਖਿੱਝਦੇ ਐਂ ਕਿ ਵੀ ਤੂੰ ਔਨਲਾਈਨ ਮੰਗਵਾਇਆ ਅਤੇ ਕਿਵੇਂ ਦਾ ਲਿਆ ਹੈ ਅਤੇ ਬਾਕੀ ਇਹ ਹੈਗੇ ਨੇ ਨੁਕਸਾਨ ਇੰਨਾ ਕਰਿਆ ਵੀ ਸਾਡੇ ਪੜੋਸੀਆਂ ਦੇ ਨਾਲ਼ ਉਹਨਾਂ ਦੀ ਵੀ ਲਾਈਟ ਖਰਾਬ ਕਰੀ ਏ ਯਾ ਤਾਂ ਤੁਸੀਂ ਮੇਰਾ ਪੈਸੇ ਵਾਪਸ ਕਰ ਦਿਓ ਨਹੀਂ ਜੇ ਪੈਸੇ ਵਾਪਸ ਕਰਨੇ ਤਾਂ ਮੈਨੂੰ ਨਵਾਂ ਪੱਖਾ ਦੇ ਦਿਓ ਧੰਨਵਾਦ